ਪੰਜਾਬ ਵਿੱਚ ਜਾਂ ਕਹਿ ਲਉ ਕਿ ਭਾਰਤ ਵਿੱਚ ਕਲਾਕਾਰਾਂ ਦੀ ਬਹੁਤ ਭਰਮਾਰ ਹੈ ਬਹੁਤ ਤਰ੍ਹਾਂ ਤਰ੍ਹਾਂ ਦੇ ਕਲਾਕਾਰ ਹਰ ਸ਼ਹਿਰ ਹਰ ਜ਼ਿਲ੍ਹੇ ਦੇ ਵਿੱਚ ਵਸੇ ਹੋਏ ਹਨ ਬੜੇ ਬੜੀਆਂ ਕਲਾਕਾਰੀਆਂ ਨੇ ਉਹਨਾਂ ਕੋਲ ਬੜਾ ਬੜਾ ਹੁਨਰ ਹੈ ਜਿਹਦੇ ਸਿਰ 'ਤੇ ਉਹਨਾਂ ਦੇ ਘਰਾਂ ਦਾ ਪੂਰਾ ਪੂਰਾ ਗੁਜ਼ਾਰਾ ਚਲਦਾ ਹੈ ਬੜਾ ਉਹਨਾਂ ਦੇ ਹੁਨਰ ਬਾ ਕਮਾਲ ਨੇ ਉਹਨਾਂ ਵਰਗਾ ਹੁਨਰ ਸ਼ਾਇਦ ਹੀ ਇੱਕ ਕਲਾਕਾਰ ਵਰਗਾ ਦੂਜੇ ਕਲਾਕਾਰ ਕੋਲ ਨਹੀਂ ਹੈ ਇਹ ਠੀਕ ਹੈ ਕਿ ਕਲਾਕਾਰਾਂ ਨੂੰ ਉਹ ਲੋੜੀਂਦੇ ਮਹੱਤਵ ਨਹੀਂ ਦਿੱਤੇ ਗਏ ਜਾਂ ਮੌਕੇ ਨਹੀਂ ਮਿਲੇ ਪਰ ਕੁਛ ਉਹਨਾਂ ਦੇ ਹੁਨਰ ਨੂੰ ਲੈ ਕੇ ਕੁਛ ਉਹਨਾਂ ਦੇ ਵਿਚਲੀ ਕਲਾਕਾਰੀ ਨੂੰ ਲੈ ਕੇ ਕਈ ਲੋਕ ਪਸੰਦ ਨਹੀਂ ਕਰਦੇ ਸੀ ਜਾਂ ਕਈ ਵਾਰ ਉਨ ਉਨ ਕਾਫੀ ਦੂਰ ਵਸਦੇ ਸੀ ਜਿਨ੍ਹਾਂ ਕਰਕੇ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ਇਸ ਕਰਕੇ ਪਰ ਅੱਜ ਦੇ ਟਾਈਮ ਦੇ ਵਿੱਚ ਅਜੋਕੇ ਟਾਈਮ ਦੇ ਵਿੱਚ ਕਲਾਕਾਰਾਂ ਨੂੰ ਹਰ ਤਰ੍ਹਾਂ ਦਾ ਮਹੱਤਵ ਮਿਲਦਾ ਹੈ ਹਰ ਤਰ੍ਹਾਂ ਦੀਆਂ ਉਹਨਾਂ ਨੂੰ ਜੋ ਜੋ ਉਹਨਾਂ ਦੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਰਹੀਆਂ ਨੇ ਔਨਲਾਈਨ ਦਾ ਜ਼ਮਾਨਾ ਆ ਗਿਆ ਹੈ ਹਰ ਕਲਾਕਾਰ ਜਿੱਥੇ ਮਰਜ਼ੀ ਬੈਠਾ ਹੋਵੇ ਉਹਦੇ ਤੱਕ ਲੋਕਾਂ ਦੀ ਪਹੁੰਚ ਹੋ ਜਾਂਦੀ ਹੈ ਉਹਨਾਂ ਨੂੰ ਜੋ ਮਹੱਤਵ ਉਹਨਾਂ ਦੀ ਕਲਾਕਾਰੀ ਦੇ ਹਿਸਾਬ ਨਾਲ ਉਹਨਾਂ ਦੇ ਹੁਨਰ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਮੁਹੱਈਆ ਹੋ ਜਾਂਦਾ ਹੈ ਹੁਣ ਕਈ ਕਈ ਇੱਦਾਂ ਦੇ ਕਲਾਕਾਰ ਨੇ ਇੱਦਾਂ ਦੇ ਸਿੰਗਰ ਨੇ ਜਿਨ੍ਹਾਂ ਜਿਨ੍ਹਾਂ ਨੂੰ ਬਹੁਤ ਜਿਨ੍ਹਾਂ ਨੂੰ ਇਹ ਬਹੁਤ ਫਰਸ਼ ਤੋਂ ਚੱਲੇ ਨੇ ਅਤੇ ਬਹੁਤ ਅਰਸ਼ਾਂ ਤੱਕ ਪਹੁੰਚ ਗਏ ਨੇ ਬੜੀਆਂ ਬੜੀਆਂ ਉੱਚਾਈਆਂ ਤੱਕ ਬੜੀਆਂ ਬੜੀਆਂ ਸਿਖਰਾਂ ਤੱਕ ਉਹ ਆਪਣੀਆਂ ਕਲਾਕਾਰੀ ਦੇ ਨਾਲ ਪਹੁੰਚ ਗਏ ਨੇ ਜਿਨ੍ਹਾਂ ਜਿਨ੍ਹਾਂ ਨੂੰ ਜਿਹੜੇ ਬਹੁਤ ਗਰੀਬੀ ਤੋਂ ਉੱਠੇ ਪਰ ਇਹ ਜਿਹੜੀਆਂ ਅੱਜ ਕੱਲ੍ਹ ਦੀਆਂ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਨੇ ਅੱਜ ਕੱਲ੍ਹ ਦੇ ਜਿਹੜੇ ਉਹਨਾਂ ਨੂੰ ਔਨਲਾਈਨ ਦੇ ਜ਼ਮਾਨੇ ਦੇ ਵਿੱਚ ਉਹਨਾਂ ਨੂੰ ਜੋ ਮਹੱਤਵ ਮਿਲਿਆ ਜੋ ਪੋਪਲੈਰਟੀ ਮਿਲੀ ਹੈ ਜਿਹਦੇ ਨਾਲ ਉਹ ਫਰਸ਼ਾਂ ਤੋਂ ਅਰਸ਼ਾਂ ਤੱਕ ਜਾ ਚੁੱਕੇ ਨੇ ਇਹ ਪਹਿਲਾਂ ਦਾ ਟਾਈਮ ਸੀ ਜਦੋਂ ਕਲਾਕਾਰਾਂ ਨੂੰ ਬਹੁਤਾ ਮਹੱਤਵ ਨਹੀਂ ਸੀ ਮਿਲਦਾ ਖਾਸ ਕਰਕੇ ਔਰਤਾਂ ਨੂੰ ਉਹਨਾਂ ਨੂੰ ਘਰ ਦੇ ਵਿੱਚ ਹੀ ਰਹਿਣ ਦਿੱਤਾ ਜਾਂਦਾ ਸੀ ਉਹਨਾਂ ਨੂੰ ਬਾਹਰ ਨਹੀਂ ਸੀ ਨਿਕਲਣ ਦਿੱਤਾ ਜਾਂਦਾ ਅਤੇ ਉਹ ਥੋੜ੍ਹਾ ਪਿੱਛੇ ਹੱਟ ਕੇ ਰਹਿ ਜਾਂਦੀਆਂ ਸੀ ਪਰ ਅੱਜ ਕੱਲ੍ਹ ਇਹ ਚੀਜ਼ ਨਹੀਂ ਆ ਅੱਜ ਕੱਲ੍ਹ ਹਰ ਕਲਾਕਾਰ ਆਪਣੀ ਸਿਖਰਾਂ ਦੀ ਬੁਲੰਦੀਆਂ ਨੂੰ ਛੂਹ ਰਿਹਾ ਹੈ